ਹੈਲੋ ਹਾਂਜੀ ਨਮਸਕਾਰ ਜੀ ਕਿੰਨੇ ਵਜੇ ਵਾਲੀ ਸਵੇਰੇ ਛੇ ਵਜੇ ਜਾਂਦੀ ਹੈਗੀ ਨੌਂ ਵਜੇ ਵੀ ਜਾਂਦੀ ਹੈਗੀ ਇੱਕ ਬਾਰ੍ਹਾਂ ਵਜੇ ਚੱਲਦੀ ਹੈਗੀ ਅਤੇ ਇੱਕ ਤਿੰਨ ਵਜੇ ਚੱਲਦੀ ਹੈਗੀ ਹਾਂ ਉਦੋਂ ਬਾਅਦ ਫੇਰ ਸੱਤ ਵਜੇ ਚੱਲਦੀ ਹੈਗੀ ਓ ਫੇਰ ਨਾਈਟ 'ਚ ਆ ਆ ਜਾਂਦੀ ਹੈਗੀ ਇੱਕ ਦੋ ਵਜੇ ਐਕਸਲ ਫਿਰੋਜ਼ਪੁਰ ਦਾ ਜਿਹੜੀ ਲੋਕਲ ਹੈਗੀ ਉਹਦਾ ਹੈਗਾ ਅੱਛਾ ਜੀ ਉਹਦਾ ਹੈਗਾ ਆਪਨੋ ਆਪਣੇ ਤੀਹ ਵੀਹ ਏ ਅਤੇ ਪੈਸੰਜਰ ਦਾ ਤਾਂ ਹੈਗਾ ਤੀਹ ਰੁਪਈਏ ਅਤੇ ਦੂਜੀ ਦਾ ਫੇਰ ਜ਼ਿਆਦਾ ਡਬਲ ਹੋਏਗਾ

ਨਹੀਂ ਦਸ ਵਜੇ ਨਹੀਂ ਜਾਂਦੀ ਜੀ ਠੀਕ ਹੈ ਜੀ ਸਟੇਸ਼ਨ ਹੈ ਜਲਾਲਾਬਾਦ ਤੋਂ ਫਿਰੋਜ਼ਪੁਰ ਆਏਗਾ ਹਾਂਜੀ ਹਾਂਜੀ ਹੋਰ ਕੁਛ ਪੁੱਛਣਾ ਚਾਹੁੰਦੇ ਹੋ ਉਹ ਆਪਣੇ ਆਉਂਦੀ ਹੈਗੀ ਇੱਕ ਨੰਬਰ 'ਤੇ ਇੱਥੇ ਜਿਹਦੇ ਅਤੇ ਦੋ ਨੰਬਰ 'ਤੇ ਵੀ ਆ ਜਾਂਦੀ ਏ

ਫਿਰੋਜ਼ਪੁਰ ਤੋਂ ਵਾਪਸ ਉੱਧਰ ਚਾਰ ਵਜੇ ਚੱਲਦੀ ਹੈ ਜੀ ਹਾਂਜੀ ਨਹੀਂ ਨਹੀਂ ਦੁਪਹਿਰੇ ਇੱਥੇ ਚਾਰ ਵਜੇ

ਸਲੀਪਰ ਹਾਂ ਹਾਂਜੀ ਹੋ ਜੂਗੀ ਜੀ ਉਹਦਾ ਤਾਂ ਜ਼ਿਆਦਾ ਹੋਏਗਾ ਜੀ

ਹਾਂਜੀ ਉਹ ਚੱਲਦੀ ਹੈਗੀ ਇੱਕ ਰਾਤ ਬਾਰ੍ਹਾਂ ਵਜੇ ਉਹ ਤੋਂ ਬਾਅਦ ਨਹੀਂ ਚੱਲਦੀ ਕੋਈ ਵੀ ਹਾਂਜੀ ਕੋਟਲਾ ਵੀ ਜਾਂਦੀ